ਤਰਨ ਤਾਰਨ ਜ਼ਿਲ੍ਹੇ ਵਿੱਚ ਸਮਾਜ ਭਲਾਈ ਵਿਕਾਸ ਪ੍ਰੋਗਰਾਮ ਅਤੇ ਬਹੁਤ ਪਹਿਲ ਕਦਮੀਆਂ ਵਿੱਚ ਅੱਗੇ ਚੱਲ ਰਹੇ ਹਨ ਜਿਹਨਾਂ ਵਿੱਚ ਸਿੱਖਿਆ ਸੰਬੰਧੀ ਸਿਹਤ ਦੇਖ ਰੇਖ ਗਰੀਬੀ ਘਟਾਉਣ ਔਰਤਾਂ ਸ਼ਸਤਰੀਕਰਨ ਆਦਿ ਸਾਰੇ ਜਿਹੜੇ ਖੇਤਰਾਂ ਵਿੱਚ ਆ ਉਹਨਾਂ ਨੂੰ ਬਹੁਤ ਸਹੂਲਤਾਂ ਅਤੇ ਉਹਨਾਂ ਨੂੰ ਜਾਣੂ ਕਰਵਾ ਕੇ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਸ ਤਰ੍ਹਾਂ ਕਿ ਜਿਹੜੇ ਨਸ਼ਿਆਂ ਦੇ ਵਪਾਰ ਆ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਨਸ਼ਿਆਂ ਤੋਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਨੁਕਸਾਨ ਹੁੰਦਾ ਏ ਉਹਦੇ ਬਾਰੇ ਦੱਸਿਆ ਜਾਂਦਾ ਏ ਬੇਟੀ ਬਚਾਓ ਬੇਟੀ ਪੜ੍ਹਾਓ ਇਹ ਇਹ ਵੀ ਸਕੀਮ ਇਹਨਾਂ ਸ਼ੁਰੂ ਕੀਤੀ ਗਈ ਹੈ ਸਰਕਾਰ ਵੱਲੋਂ ਜਿਸ ਵਿੱਚ ਕਿ ਕੁੜੀਆਂ ਨੂੰ ਸਰਕਾਰੀ ਉਹਨਾਂ ਦੀ ਪੜ੍ਹਾਈ ਫਰੀ ਕੀਤੀ ਜਾਂਦੀ ਏ ਉਹਨਾਂ ਨੂੰ ਹੋਰ ਕਈ ਤਰ੍ਹਾਂ ਦੀ ਸਹੂਲਤਾਂ ਕਿਤਾਬਾਂ ਵਰਦੀਆਂ ਆਦਿ ਫਰੀ ਦਿੱਤੀਆਂ ਜਾਂਦੀਆਂ ਜਿਸ ਇਸ ਸਕੀਮ ਰਾਹੀਂ ਕਿਉਂਕਿ ਬੱਚੇ ਆਪਣੇ ਬੇਟੀਆਂ ਨੂੰ ਜਿਹੜਾ ਵਾ ਉਹ ਮਾਨ ਸਨਮਾਨ ਮਿਲਦਾ ਵਾ ਉਹਨਾਂ ਨੂੰ ਅਸੀਂ ਪੜ੍ਹਾ ਸਕਦੇ ਹਾਂ ਅਤੇ ਉਹ ਇਸ ਤਰ੍ਹਾਂ ਬੇਟੀਆਂ

ਬੇਟੀਆਂ ਨੂੰ ਪੜ੍ਹਾ ਕੇ ਕਿਸੇ ਚੰਗੇ ਕੰਮ 'ਤੇ ਵੀ ਲਵਾ ਸਕਦੇ ਹਾਂ ਜਿਸ ਨਾਲ ਆਮ ਗਰੀਬ ਲੋਕਾਂ ਨੂੰ ਬਹੁਤ ਲਾਹਾ ਮਿਲਦਾ ਵਾ ਕਿਉਂ ਉਹ ਕਿਉਂਕਿ ਬੇਟੀਆਂ ਨੂੰ ਇੱਕ ਚੰਗੀ ਸਿੱਖਿਆ ਦੇ ਸਕਦੇ ਅਤੇ ਜਿਸ ਨਾਲ ਉਹ ਬੇਟੀਆਂ ਹਰ ਇੱਕ ਖੇਤਰ ਵਿੱਚ ਆਪਣਾ ਯੋਗਦਾਨ ਅੱਗੇ ਦੇ ਸਕਦੀਆਂ ਅਤੇ ਇਸ ਲਈ ਸਕੀਮ ਇਹ ਚਾਲੂ ਕੀਤੀਆਂ ਅਤੇ ਬਹੁਤ ਸਾਰੇ ਲੋਕ ਲਾਹਾ ਲੈ ਰਹੇ ਹਨ